ਹੈਲੋ ਹਾਂਜੀ ਬਾਈ ਸਾਹਿਬ ਹਾਂਜੀ ਹਾਂਜੀ ਐਵੇਂ ਤਾਂ ਭਾਈ ਸਾਹਿਬ ਸਕੂਲ ਤਾਂ ਸਾਰੇ ਹੀ ਵਧੀਆ ਨੇ ਆਪਣੇ ਸ਼ਹਿਰ ਵਿੱਚ ਆਤਮ ਵਾਲਾ ਸਕੂਲ ਵੀ ਹੈਗਾ ਸਕਰੇਡ ਹਾਰਟ ਸਕੂਲ ਵੀ ਹੈਗਾ ਸ਼ਿਵਾਲਿਕ ਪਬਲਿਕ ਸਕੂਲ ਵੀ ਹੈਗਾ ਅਤੇ ਇਸ ਕਿਹੜੀ ਮੋਡਲ ਸਕੂਲ ਵੀ ਹੈਗਾ ਲੇਕਿਨ ਮੈਨੂੰ ਆਪਣੇ ਸ਼ਹਿਰ ਦਾ ਸਭ ਤੋਂ ਬੈਸਟ ਸਰਵਿਸਕਾਰੀ ਸਕੂਲ ਲੱਗਦਾ ਅਤੇ ਕੋਈ ਹਾਂਜੀ ਹਾਂਜੀ ਹਾਂਜੀ ਹਾਂਜੀ ਭਈਆ ਬਹੁਤ ਵਧੀਆ ਸਕੂਲ ਹੈ ਬਾਈ ਸਾਹਿਬ ਉੱਥੇ ਨਾ ਬੱਚਿਆਂ ਨੂੰ ਹਰ ਤਰ੍ਹਾਂ ਦੇ ਸੰਸਕਾਰ ਦਿੱਤੇ ਜਾਂਦੇ ਨੇ ਅਤੇ ਜਿਹੜਾ ਜਿਵੇਂ ਬਾਕੀ ਸਕੂਲ ਵਾਲੇ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਹੈ ਤਾਂ ਐਕਸਟਰਾ ਖਰਚਾ ਬਹੁਤ ਲੈਂਦੇ ਹੈ ਤਾਂ ਐਸ ਸਕੂਲ 'ਚ ਤੁਹਾਨੂੰ ਫੀਸ ਵੀ ਜਾਇਜ਼ ਲੱਗੇਗੀ ਕੋਈ ਫੀਸ ਵੀ ਜਿਆਦਾ ਨਹੀਂ ਰਹੇਗੀ ਅਡਮਿਸ਼ਨ ਫੀਸ ਵੀ ਬਹੁਤ ਥੋੜ੍ਹੀ ਹੈ ਬਾਕੀ ਸਕੂਲਾਂ ਦੇ ਨਾਲੋਂ ਅਤੇ ਪੇਰੈਂਟਸ ਵਾਸਤੇ ਵੀ ਮਤਲਬ ਜਦੋਂ ਵੀ ਕੋਈ ਫੈਸਟੀਵਲ ਹੁੰਦਾ ਤਿਉਹਾਰ ਹੁੰਦਾ ਹਰ ਤਰ੍ਹਾਂ ਦਾ ਮਨਾਇਆ ਜਾਂਦਾ ਅਤੇ ਪੇਰੈਂਟਸ ਵੀ ਇਨਵਾਈਟੀਡ ਕੀਤਾ ਜਾਂਦਾ ਹਰ ਟਾਈਮ 'ਤੇ ਬੱਚੇ ਨੂੰ ਵੇਖਣ ਦਾ ਮੌਕਾ ਮਿਲਦਾ ਉੱਥੇ ਅਤੇ ਤੁਸੀਂ ਮਤਲਬ ਭਾਵੇਂ ਅਡਮਿਸ਼ਨ ਚਾਹੇ ਬਾਅਦ ਬਾਰੇ ਸੋਚ ਲੈਂਦਾ ਭਾਵੇਂ ਤੁਸੀਂ ਜਾ ਕੇ ਸਕੂਲ 'ਚ ਵਿਜ਼ਿਟ ਵੀ ਕਰ ਸਕਦੇ ਹੋ ਅਤੇ ਉੱਥੋਂ ਦੇ ਜਦੋਂ ਤੁਸੀਂ ਪ੍ਰਿੰਸੀਪਲ ਹੈੱਡ ਓਫਿਸ 'ਚ ਜਾ ਕੇ ਮਿਲੋਗੇ ਨਾ ਅਤੇ ਤੁਹਾਨੂੰ ਗੱਲਾਂ ਤੋਂ ਹੀ ਉਹਨਾਂ ਦੇ ਬਹੁਤ ਜਿਆਦਾ ਕੁਛ ਸਿੱਖਣ ਨੂੰ ਮਤਲਬ ਵੇਖਣ ਨੂੰ ਮਿਲੇਗਾ ਕਿ ਵਾਕਈ ਉਹ ਸਕੂਲ ਬਹੁਤ ਵਧੀਆ ਸਕੂਲ ਹੈ ਅਤੇ ਬਾਕੀ ਦੇਖੋ ਤੁਸੀਂ ਹੁਣ ਜੇ ਤੁਸੀਂ ਬੱਚੇ ਨੇ ਨਰਸਰੀ ਤੁਸੀਂ ਕਹਿੰਦੇ ਹੋ ਐਲ ਕੇ ਜੀ ਕੀਤੀ ਹੋਈ ਹੈ ਨਾ ਪਰ ਤੁਸੀਂ ਯੂ ਕੇ ਜੀ 'ਚ ਅਡਮਿਸ਼ਨ ਕਰਾਉਂਦੇ ਹੋ ਅਤੇ ਤੁਹਾਡੇ ਬੱਚੇ ਦੀ ਉਮਰ ਕਿੰਨੀ ਬਾਈ ਸਾਹਿਬ ਭਾਈ ਸਾਹਿਬ ਨਹੀਂ ਤਿੰਨ ਸਾਲ ਤੁਸੀਂ ਗਲਤ ਦੱਸ ਰਹੇ ਹੋ ਤਿੰਨ ਸਾਲ ਦਾ ਬੱਚਾ ਤਾਂ ਬਹੁਤ ਛੋਟਾ ਹੁੰਦਾ ਤਾਂ ਇਟ ਮੀਨਸ ਉਹਨੇ ਹਜੇ ਨਰਸਰੀ ਐਲ ਕੇ ਜੀ ਕੀਤੀ ਹੈ ਤਾਂ ਫੇਰ ਉਹ ਚਾਰ ਸਾਲ ਤੋਂ ਅੱਪ ਹੋਏਗਾ ਨਾ ਅਤੇ ਇਕੱਠੀਆਂ ਅੱਛਾ ਨਹੀਂ ਫਿਰ ਬਾਈ ਸਾਹਿਬ ਤੁਹਾਡਾ ਬੱਚਾ ਬਹੁਤ ਛੋਟਾ ਅਜੇ ਅਤੇ ਮੇਰੀ ਸਲਾਹ ਮੰਨੋ ਤਾਂ ਆਪਾਂ ਇੱਕ ਕਲਾਸ ਉਹਨੂੰ ਪਿਛਲੀ ਵਾਰੀ ਰਿਪੀਟ ਕਰਵਾਵਾਂਗੇ ਤੁਸੀਂ ਕਹਿ ਰਹੇ ਨਾ ਉੱਥੇ ਅਟਮੋਸਫਰ ਵਧੀਆ ਨਹੀਂ ਮਿਲਿਆ ਸੀਗਾ ਤਾਂ ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗੀ ਅਤੇ ਇੱਕ ਕਲਾਸ ਪਿੱਛੇ ਕਰਾ ਲਓ ਕਿਉਂਕਿ ਨਾ ਉਹ ਸਕੂਲ ਵਾਲੇ ਨਾ ਐਂਟਰ ਟੈਸਟ ਲੈਂਦੇ ਹੈ ਚਾਹੇ ਛੋਟੀ ਕਲਾਸ ਹੈ ਅਤੇ ਤੁਹਾਨੂੰ ਇੱਕ ਵਾਰੀ ਬੱਚੇ ਨੂੰ ਲੈ ਕੇ ਜਾਣਾ ਪਏਗਾ ਉੱਥੇ ਅਤੇ ਇੱਕ ਐਂਟਰ ਟੈਸਟ ਦੇਣਾ ਪਏਗਾ ਅਤੇ ਤੁਸੀਂ ਸਕੂਲ ਵਿਜ਼ਿਟ ਕਰਕੇ ਆਓ ਸਕੂਲ ਦੇਖ ਕੇ ਆਓ ਅਤੇ ਉੱਥੋਂ ਦੇ ਟੀਚਰ ਵੀ ਬਹੁਤ ਵਧੀਆ ਨੇ ਅਧਿਆਪਕ ਜਿਹੜੇ ਉੱਥੇ ਪੜ੍ਹਾਉਂਦੇ ਹੈ ਨਾ ਅਤੇ ਬੜੀ ਵਧੀਆ ਮਤਲਬ ਬੱਚੇ ਨੂੰ ਹਰ ਤਰ੍ਹਾਂ ਦੇ ਸੰਸਕਾਰ ਜਿਵੇਂ ਪਰਮਾਤਮਾ ਨਾਲ ਵੀ ਜੋੜਿਆ ਜਾਂਦਾ ਦੇਸ਼ ਭਗਤੀ ਨਾਲ ਵੀ ਜੋੜਿਆ ਜਾਂਦਾ ਜਦੋਂ ਕਿ ਅੱਜ ਦੀ ਆਪਣੀ ਜਨਰੇਸ਼ਨ ਹੈ ਇਹ ਚੀਜ਼ਾਂ ਨੂੰ ਛੱਡੀ ਬੈਠੀ ਹੈ ਅਤੇ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਪਰ ਮੈਂ ਤਾਂ ਜਿਵੇਂ ਬਾਈ ਸਾਹਿਬ ਤੁਸੀਂ ਕਹਿ ਰਹੇ ਹੋ ਉਮਰ ਛੋਟੀ ਅਤੇ ਮੈਂ ਤੁਹਾਨੂੰ ਸਲਾਹ ਦੇਵਾਂਗੀ ਕਿ ਇੱਕ ਸਾਲ ਉਹਨੂੰ ਹੋਰ ਲਗਵਾ ਲਓ ਤਾਂ ਕਿ ਜਿਹੜਾ ਉਹਨੇ ਪਿੱਛੇ ਜੇ ਕੋਈ ਬੇਸ ਰਹਿੰਦਾ ਤਾਂ ਉਹ ਕਲੀਅਰ ਹੋ ਜਾਏਗਾ ਬਾਕੀ ਤੁਹਾਨੂੰ ਜੇ ਉੱਥੋਂ ਦੇ ਟੀਚਰ ਦੱਸ ਦੇਵੇਗਾ ਉੱਥੇ ਦਾ ਅਧਿਆਪਕ ਤੁਹਾਨੂੰ ਦੱਸ ਦੇਵੇਗਾ ਹੈ ਨਾ ਉਹ ਵਧੀਆ ਤੁਹਾਨੂੰ ਗਾਈਡ ਕਰੇਗਾ ਹਾਂਜੀ ਹਾਂਜੀ ਬਾਈ ਸਾਹਿਬ ਠੀਕ ਹੈ ਬਾਈ ਸਾਹਿਬ